ਮੈਂ ਆਪਣਾ ਨੈਗੇਟਿਵ ਐਕਸਪੀਰੀਅੰਸ ਤੁਹਾਡੇ ਨਾਲ ਇਹ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਮੈਂ ਬਹੁਤ ਜ਼ਿਆਦਾ ਪੈਸੇ ਲਗਾ ਕੇ ਆਪਣਾ ਇੱਕ ਲਹਿੰਗਾ ਤਿਆਰ ਕੀਤਾ ਸੀਗਾ ਜਿਹੜਾ ਕਿ ਮੈਂ ਆਪ ਸਿਲਾਈ ਕੀਤਾ ਸੀਗਾ ਔਰ ਆਪ ਹੀ ਬੁਣਾਈ ਕੀਤਾ ਔਰ ਇੰਨੀ ਜ਼ਿਆਦਾ ਮਿਹਨਤ ਕਰਨ ਤੋਂ ਬਾਅਦ ਜਦੋਂ ਉਹ ਸਾਰਾ ਰੈਡੀ ਹੋ ਗਿਆ ਲੁੱਕ ਵਾਈਜ਼ ਤਾਂ ਬਹੁਤ ਹੀ ਵਧੀਆ ਸੀਗਾ ਪਰ ਜਦੋਂ ਉਹਨੂੰ ਮੈਂ ਪਾਉਣ ਲੱਗੀ ਤਾਂ ਉਹ ਇੱਕ ਦੋ ਵਾਰ ਹੀ ਪਿਆ ਕਿਉਂਕਿ ਉਹ ਕੱਪੜੇ ਦੇ ਵਿੱਚ ਮਜ਼ਬੂਤੀ ਨਹੀਂ ਸੀ ਉਹ ਬਹੁਤ ਹੀ ਹਲਕਾ ਕੱਪੜਾ ਨਿਕਲਿਆ ਪਰ ਉਸ ਨੂੰ ਬਣਾਉਣ ਦੇ ਵਿੱਚ ਮੈਂ ਬਹੁਤ ਜ਼ਿਆਦਾ ਮਿਹਨਤ ਕੀਤੀ ਸੀਗੀ ਸੋ ਇਹ ਮੇਰਾ ਇੱਕ ਨੈਗੇਟਿਵ ਐਕਸਪੀਰੀਅਸ ਰਿਹਾ ਕਿ ਮੈਂ ਇੰਨੀ ਜ਼ਿਆਦਾ ਮਿਹਨਤ ਵੀ ਕੀਤੀ ਪਰ ਮੈਂ ਜ਼ਿਆਦਾ ਉਸ ਡਰੈਸ ਨੂੰ ਉਸ ਲਹਿੰਗੇ ਨੂੰ ਮੈਂ ਪਾ ਵੀ ਨਹੀਂ ਸਕੀ ਸੋ ਮੈਨੂੰ ਬਹੁਤ ਦੁੱਖ ਹੋਇਆ ਸੀਗਾ ਉਦੋਂ ਆਪਣੀ ਮਿਹਨਤ ਦੇ ਬਾਵਜੂਦ ਵੀ ਮੈਂ ਉਸ ਲਹਿੰਗੇ ਨੂੰ ਜਿਹੜਾ ਆ ਉਹ ਜ਼ਿਆਦਾ ਟਾਇਮ ਲਈ ਇਸਤੇਮਾਲ ਨਹੀਂ ਸੀ ਕਰ ਸਕੀ ਸੋ ਇਹ ਚੀਜ਼ ਮੇਰੇ ਲਈ ਇੱਕ ਨੈਗੇਟਿਵ ਐਕਸਪੀਰੀਅਸ ਸੀਗਾ ਮੇਰਾ